ਹੈਲੋ ਹੈਲੋ ਹਾਂਜੀ ਸਿਸਟਰ ਕਿਵੇਂ ਹੋ ਵਧੀਆ ਮੈਂ ਅੱਜ ਵਧਾਈਆਂ ਤੁਹਾਨੂੰ ਤੁਹਾਡਾ ਵੀਜ਼ਾ ਆ ਗਿਆ ਹਾਂਜੀ ਮੈਂ ਅੱਜ ਅਬੈਂਸੀ ਗਿਆ ਸੀਗਾ ਅਤੇ ਮੈਨੂੰ ਉੱਥੇ ਪਤਾ ਲੱਗ ਗਿਆ ਮੈਂ ਕਿਹਾ ਦੀਦੀ ਦਾ ਵੀਜ਼ਾ ਆ ਗਿਆ ਤਾਂ ਚਲੋ ਮੈਨੂੰ ਬਹੁਤ ਖੁਸ਼ੀ ਹੋਈ ਤਾਂ ਚਲੋ ਵਧੀਆ ਤੁਹਾਨੂੰ ਵਧਾਈਆਂ ਅਤੇ ਤੁਹਾਨੂੰ ਵਧੀਆ ਅਤੇ ਤੁਹਾਨੂੰ ਪਰਮਾਤਮਾ ਤਰੱਕੀਆਂ ਬਖਸ਼ੇ ਅਤੇ ਹਾਂਜੀ ਤਾਂ ਹੋਰ ਕਿੱਦਾਂ

ਹਾਂਜੀ ਹਾਂਜੀ ਹਾਂਜੀ ਜੀ ਜੀ ਹਾਂਜੀ ਚਲੋ ਐਡੀ ਕੋਈ ਗੱਲ ਨਹੀਂ ਹੁੰਦੀ ਜੀ ਬਾਹਰ ਰਹਿਣਾ ਵੀ ਕੋਈ ਬਹੁਤਾ ਔਖਾ ਨਹੀਂ ਹੈਗਾ ਲੋਕ ਜਾਂਦੇ ਹੀ ਨੇ ਅਤੇ ਬਹੁਤ ਸਾਰੀਆਂ ਕੁੜੀਆਂ ਹੁਣ ਜਿਵੇਂ ਆਪਣੇ ਪੰਜਾਬ 'ਚ ਆਪਾਂ ਦੇਖਦੇ ਹਾਂ ਆਪਾਂ ਗਈਆਂ ਹੀ ਹੈ ਅਤੇ ਜ਼ਿਆਦਾ ਕੋਈ ਐਡਾ ਔਖਾ ਨਹੀਂ ਹੁੰਦਾ ਹੈਗਾ ਅਤੇ ਰੈਂਟ ਵਗੈਰਾ ਦਾ ਕੋਈ ਫਿਕਰ ਕਰਨ ਦੀ ਜ਼ਰੂਰਤ ਨਹੀਂ ਹੈਗੀ ਹੈ ਨਾ ਵੀ ਤੁਸੀਂ ਸਟੱਡੀ ਬੇਸ 'ਤੇ ਜਾਣਾ ਹੈਗਾ ਤੁਸੀਂ ਜ਼ਿਆਦਾ ਧਿਆਨ ਆਪਣਾ ਸਟੱਡੀ 'ਚ ਹੀ ਲਗਾਉਣਾ ਹੈਗਾ ਠੀਕ ਹੈ ਕੋਈ ਮਤਲਬ ਕਿ ਪਾਰਟ ਟਾਈਮ ਜੋਬ ਕਰਨਾ ਕੋਈ ਜ਼ਿਆਦਾ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਜੋਬ ਹੀ ਕਰਨੀ ਆ ਅਤੇ ਤੁਸੀਂ ਜ਼ਿਆਦਾਤਰ ਸਟੱਡੀ 'ਤੇ ਫੋਕਸ ਕਰਨਾ ਗਾ ਅਤੇ ਰੈਂਟ ਵਗੈਰਾ ਦਾ ਕੋਈ ਚੱਕਰ ਨਹੀਂ ਹੈਗਾ ਅਤੇ ਹੋਰ ਹਾਂਜੀ ਹਾਂਜੀ ਹਾਂਜੀ ਸਮਝ ਰਹੇ ਅਸੀਂ ਸਮਝ ਰਹੇ ਹਾਂ ਅਤੇ ਬਾਕੀ ਚਲੋ ਬਾਹਰ ਵੀ ਫਿਊਚਰ ਐਡਾ ਵਧੀਆ ਹੀ ਆ ਦੇਖੋ ਅਦਰ ਕੰਟਰੀ ਦੇ ਵਿੱਚ ਜਾਂਦੇ ਹਾਂ ਹੈਨਾ ਸਾਨੂੰ ਵਧੀਆ ਹੀ ਲੱਗਦਾ ਹੈਗਾ ਠੀਕ ਹੈ ਆਪਣੇ ਇੰਡੀਆ ਨਾਲੋਂ ਤਾਂ ਵਧੀਆ ਹੀ ਸਿਸਟਮ ਆ ਉੱਥੇ ਹਾਂਜੀ ਹਾਂਜੀ ਹਾਂਜੀ